ਕੁਪੋਸ਼ਣ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਪੰਜਾਬ ਦੇ ਛੋਟੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਇਸਦਾ ਮੁੱਖ ਕਾਰਨ ਹੈ ਜ਼ਿਆਦਾ ਤੋਂ ਜ਼ਿਆਦਾ ਗਰੀਬ ਪਰਿਵਾਰ ਬੇਰੁਜ਼ਗਾਰੀ ਬੇਰੋਜਗਾ ਬੇਰੁਜ਼ਗਾਰੀ ਕਾਰਨ ਲੋਕਾਂ ਨੂੰ ਪ੍ਰੋਪਰ ਰੋਟੀ ਖਾਣ ਪੀਣ ਨਹੀਂ ਮਿਲਦਾ ਜੋ ਡੇਲੀ ਨੀਡਸ ਫਰੂਟਸ ਭੋਜਨ ਮਿਲਕ ਇਸਨੂੰ ਵੀ ਉਹ ਆਪਣੀ ਪੂਰਤੀ ਖਾਣੇ ਵਿੱਚ ਨਹੀਂ ਕਰਦੇ ਇਸ ਨਾਲ ਕੁਪੋਸ਼ਣ ਜ਼ਿਆਦਾਤਰ ਬੱਚਿਆਂ ਵਿੱਚ ਆਮ ਦੇਖਿਆ ਜਾਂਦਾ ਹੈ ਜਿਸ ਨਾਲ ਬੱਚੇ ਦਾ ਪੂਰਨ ਤੌਰ 'ਤੇ ਵਿਕਾਸ ਨਹੀਂ ਹੁੰਦਾ ਵਿਕਾਸ ਨਾ ਹੋਣ ਦਾ ਕਾਰਨ ਬੱਚੇ ਦਾ ਮਾਇੰਡ ਦਿਮਾਗ ਵੀ ਪ੍ਰੋਪਰ ਤਰ੍ਹਾਂ ਪਰ ਪਰੋਪਰ ਤਰ੍ਹਾਂ ਕੰਮ ਨਹੀਂ ਕਰਦਾ ਕੁਪੋਸ਼ਣ ਨੂੰ ਦੂਰ ਕਰਨ ਲਈ ਸਰਕਾਰਾਂ ਨੂੰ ਵੀ ਇਸ 'ਤੇ ਇਸ ਇਸ ਵਿੱਚ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਾਰਨ ਇਹ ਹੈ ਕਿ ਜੋ ਗਰੀਬ ਬੰਦਾ ਹੈ ਉਸ ਨੂੰ ਪ੍ਰੋਪਰ ਤੌਰ 'ਤੇ ਖਾਣ ਪੀਣ ਦੇ ਜੋ ਚੀਜ਼ਾਂ ਬੱਚਿਆਂ ਲਈ ਹੈ ਉਸ ਨੂੰ ਉਹ ਵੀ ਮਾਰਕੀਟ ਤੋਂ ਮਿਲਾਵਟ ਵਾਲੀਆਂ ਹੀ ਮਿਲਦੀਆਂ ਨੇ ਜੇਕਰ ਉਸ ਦੀ ਉਹ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤ ਲੈ ਕਰ ਜਾ ਨਹੀਂ ਸਕਦਾ ਪਰ ਜਿੰਨੀ ਉਹ ਲੈ ਕੇ ਜਾਂਦਾ ਬੱਚੇ ਨੂੰ ਜ਼ਿਆਦਾ ਜ਼ਿਆਦਾ ਜ਼ਰੂਰਤ ਹੁੰਦੀ ਆ ਬਟ ਉਹ ਘੱਟ ਲੈ ਕੇ ਜਾਂਦਾ ਹੈ ਸਾਨੂੰ ਚਾਹੀਦਾ ਹੈ ਚੰਗਾ ਪਾਣੀ ਸਭ ਤੋਂ ਮੇਨ ਜ਼ਿੰਦਗੀ ਦਾ ਜੋ ਹਿੱਸਾ ਹੈ ਪਾਣੀ ਜੇਕਰ ਸਾਡਾ ਪਾਣੀ ਹੀ ਗੰਧਲਾ ਅਸੀਂ ਪੀਆਂਗੇ ਪਾਣੀ ਗੰਧਲਾ ਹੋਣ ਦਾ ਕਾਰਨ ਵੀ ਸਾ ਅਸੀਂ ਆਪ ਲੋਕ ਹਾਂ ਦਰੱਖਤ ਕੱਟ ਰਹੇ ਹਾਂ ਪਲਾਸਟਿਕ ਨੂੰ ਬਹੁਤ ਤਰੀਕੇ ਨਾਲ ਗੰਦਗੀ ਤਰ੍ਹਾਂ ਫੈਲਾ ਦਿੰਦੇ ਨੇ